ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਧਾਰਮਿਕ ਗ੍ਰੰਥ ਵਿੱਚ ਜ਼ਿਆਦਾਤਰ ਲੋਕ ਪੰਜਾਬ ਪੰਜਾਬੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਕਰਦੇ ਆ ਅਤੇ ਜ਼ਿਆਦਾਤਰ ਲੋਕ ਗ੍ਰੰਥ ਸਾਹਿਬ ਨੂੰ ਮੰਨਦੇ ਹੈ ਅਤੇ ਬੱਟ ਜੋ ਹਿੰਦੂ ਲੋਕ ਹੈ ਉਹ ਵੇਦ ਦੀ ਵਰਤੋਂ ਕਰਦੇ ਹੈ ਵੇਦ ਦੀ ਵਰਤੋਂ ਕਰਦੇ ਹੈ ਅਲੱਗ ਅਲੱਗ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਦੀ ਵਰਤੋਂ ਕਰਦੇ ਆ ਪਰ ਪੰਜਾਬ ਵਿੱਚ ਜ਼ਿਆਦਾਤਰ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਆ